ਹੈਲੋ ਹਾਂਜੀ ਤੁਸੀਂ ਹੇਅਰ ਮਾਸਟਰਜ਼ ਵਾਲੇ ਬੋਲ ਰਹੇ ਹੋ ਹਾਂਜੀ ਮੈਮ ਮੈਂ ਜਸਵੀਰ ਕੌਰ ਬੋਲ ਰਹੀ ਹਾਂ ਜੀ ਮੇਰੇ ਨਾ ਘਰ ਫੰਕਸ਼ਨ ਹੈ ਜੀ ਮੇਰੀ ਬੇਟੀ ਦਾ ਵਿਆਹ ਹੈ ਜੀ ਤਿੰਨ ਨਵੰਬਰ ਤਿੰਨ ਦਸੰਬਰ ਦਾ ਸੋਰੀ ਮੈਂ ਨਾ ਤੁਹਾਡੇ ਕੋਲੋਂ ਹੇਅਰ ਸਟਾਈਲਜ਼ ਬਾਰੇ ਪੁੱਛਣਾ ਸੀਗਾ ਕਿ ਜਿੱਦਾਂ ਅਲੱਗ ਅਲੱਗ ਫੰਕਸ਼ਨਜ਼ ਹੈ ਤਾਂ ਉਹਦਾ ਕਿੱਦਾਂ ਕਿੱਦਾਂ ਤੁਸੀਂ ਹੇਅਰ ਸਟਾਈਲ ਕਰੋਂਗੇ ਜਿੱਦਾਂ ਮਹਿੰਦੀ ਦਾ ਫੰਕ ਪਹਿਲਾਂ ਸਭ ਤੋਂ ਪਹਿਲਾਂ ਬੈਂਗਲ ਸੇਰੇਮਨੀ ਹੈ ਫਿਰ ਪਾਠ ਹੈ ਫਿਰ ਮਹਿੰਦੀ ਦਾ ਫੰਕਸ਼ਨ ਹੈ ਵੱਟਣਾ ਹੈ ਜਾਗੋ ਹੈ ਫਿਰ ਮੈਰਿਜ਼ ਹੈ ਰੀਸੈਪਸ਼ਨ ਹੈ ਤੁਸੀਂ ਕਿੱਦਾਂ ਕਿੱਦਾਂ ਦੇ ਹੇਅਰ ਸਟਾਈਲਜ਼ ਕਰ ਲੈਂਦੇ ਹੋ ਜੀ ਏਜ਼ ਦੇ ਅਕੋਡਿੰਗ ਜੀ ਮੈਂ ਬੰਨ ਬਣਾਉਣਾ ਚਾਹੁੰਦੀ ਹਾਂ ਬਰੇਸ ਨਾਲ ਹਾਂਜੀ ਹੋਰ ਜਾਗੋ 'ਤੇ ਗੁੱਤ ਕਰਨਾ ਚਾਹੁੰਦੀ ਹਾਂ ਜੀ ਹਾਂਜੀ ਪਰਾਂਦੇ ਪਰਾਂਦਾ ਵੀ ਲਗਾਉਣਾ ਚਾਹੁੰਦੀ ਹਾਂ ਜੀ ਮੈਰਿਜ਼ 'ਤੇ ਜੀ ਮੈਂ ਬੰਨ ਬਣਾ ਲਣਗੀ ਬੰਨ ਬਣਾ ਲਵਾਂਗੀ ਜੀ ਬਰੇਸ ਕਰਕੇ ਅੱਗਿਓ ਅਤੇ ਰੀਸੈਪਸ਼ਨ 'ਤੇ ਕਰਲ ਪਵਾਉਣੇ ਹੈ ਮੈਸੀ ਜਿਹਾ ਹੀ ਹੈ ਜੀ ਠੀਕ ਹੈ ਜੀ ਤੁਸੀਂ ਅਵੇਲੇਵਲ ਹੋ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਆ ਕੇ ਮਿਲ ਸਕਦਾ ਸਕਦੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਮਿਲਦੀ ਹਾਂ ਜੀ ਫਿਰ ਆ ਕੇ